ਤਕਨੀਕੀ ਸੁਧਾਰ ਦੇ ਮਾਮਲੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ੍ਹ ਆ ਰਹੀ ਹੈਗੀ ਸਾਈਬਰ ਕ੍ਰਾਈਮ ਬਹੁਤ ਲੋਕਾਂ ਦੇ ਪੈਸੇ ਆਪਣੇ ਆਪ ਅਕਾਊਂਟ 'ਚੋਂ ਨਿਕਲ ਜਾਂਦੇ ਹਨ ਜਾਂ ਕੋਈ ਉਹਨਾਂ ਨੂੰ ਕੋਲ ਆਉਂਦੀ ਹੈਗੀ ਹੈ ਉਹ ਰਿਸੀਵ ਕਰਦੇ ਉਦੋਂ ਪੈਸੇ ਨਿਕਲ ਜਾਂਦੇ ਹੈ ਜਾਂ ਉਹ ਉਹਨਾਂ ਨੂੰ ਕੋਈ ਓ ਟੀ ਪੀ ਮਿਲਦਾ ਹੈਗਾ ਉੱਥੋਂ ਨਿਕਲ ਜਾਂਦੇ ਹੈਗੇ ਹੈ ਜਾਂ ਕੋਈ ਕਸਟਮਰ ਕੇਅਰ ਬਣ ਕੇ ਬੈਂਕ ਦੇ ਤਾਂ ਵੀ ਪੈਸੇ ਨਿਕਲ ਜਾਂਦੇ ਹਨ ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ ਸਰਕਾਰ ਨੂੰ ਇਸ ਨੂੰ ਥੋੜ੍ਹਾ ਜਿਹਾ ਸਖ਼ਤੀ ਨਾਲ਼ ਨਜਿੱਠਣਾ ਚਾਹੀਦਾ ਹੈਗਾ ਅਤੇ ਲੋਕਾਂ ਦੀ ਜਿਹੜੀ ਹਾਰਡ ਵਰਕਿੰਗ ਮ ਮਨੀ ਹੈਗੀ ਆ ਉਹ ਉਹ ਇਸ ਤਰ੍ਹਾਂ ਬੱਚ ਸਕਦੀ ਹੈਗੀ ਹੈ ਅਤੇ ਦੂਸਰਾ ਨੰਬਰ ਹੈਗਾ ਜਿਹੜੇ ਆਧਾਰ ਕਾਰਡ ਬਣਾਏ ਗਏ ਹਨ ਅਤੇ ਇਹ ਵੀ ਮੋਬਾਇਲ ਨਾਲ਼ ਲਿੰਕ ਹੋਣੇ ਚਾਹੀਦੇ ਹੈ ਵੀ ਅਗਰ ਕੋਈ ਬ ਕਿਸੇ ਨੂੰ ਕੋਈ ਕੋਈ ਫਰੋਡ ਕਰਦਾ ਹੈਗਾ ਹੈ ਕਿਸੇ ਵੀ ਤਰ੍ਹਾਂ ਦਾ ਤਾਂ ਉਹਨੂੰ ਥੋੜ੍ਹਾ ਜਿਹਾ ਪਛਾਨਣਾ ਸੌਖਾ ਹੈ ਕਿਉਂਕਿ ਆਧਾਰ ਕਾਰਡ ਵਿੱਚ ਫਿੰਗਰ ਪ੍ਰਿੰਟ ਆਉਂਦੇ ਹਨ ਤੁਹਾਡੇ ਅੱਖਾਂ ਵਗੈਰਾ ਸਕੈਨ ਹੁੰਦੀਆਂ ਹਨ ਅਤੇ ਇਹ ਵੀ ਇੱਕ ਪੁਆਇੰਟ ਹੈਗਾ ਜੀ ਅਤੇ ਬਾਕੀ ਹੋਰ ਜਿਹੜੇ ਹੈਗੇ ਨੇ ਉਹ ਹੈਗਾ ਕਿ ਜਿਹੜੀ ਵਾਇਸ ਕਮਾਂਡਸ ਹੈਗੀਆਂ ਉਹ ਖੇਤਰੀ ਭਾਸ਼ਾਵਾਂ ਵਿੱਚ ਵੀ ਹੋਣੀਆਂ ਚਾਹੀਦੀਆਂ ਹਨ ਵੀ ਠੀਕ ਹੈ ਅਸੀਂ ਯੂਟਿਊਬ 'ਤੇ ਅੰਗਰੇਜ਼ੀ ਬੋਲ ਕੇ ਅਸੀਂ ਕੁਛ ਲੱਭਣਾ ਹੋਵੇ ਲੱਭ ਸਕਦੇ ਹਾਂ ਪਰ ਇਹ ਚੀਜ਼ ਖੇਤਰੀ ਭਾਸ਼ਾਵਾਂ ਵਿੱਚ ਵੀ ਹੋਣੀ ਚਾਹੀਦੀਆਂ ਹਨ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਉਹ ਅੰਗਰੇਜ਼ੀ ਨਹੀਂ ਜਾਣਦੇ ਹੈਗੇ ਅਤੇ ਇਸ ਲਈ ਇਹਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਭਾਰਤ ਦੇਸ਼ ਹੈ ਉਹ ਉਹ 'ਚ ਬਹੁਤ ਸਾਰੇ ਖੇਤਰ ਹਨ ਕਈ ਤਰ੍ਹਾਂ ਦੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਸ ਲਈ ਇਹ ਸਾਰੇ ਸੁਧਾਰ ਕਰਨੇ ਜ਼ਰੂਰੀ ਹਨ